ਪਸ਼ੂ ਪਾਲਣ ਆਮ ਮਾਸ ਆਂਡੇ ਦੁੱਧ ਅਤੇ ਉਹਨਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਕਾਰੋਬਾਰ ਪੇਸ਼ ਕਰਦਾ ਹੈ ਜਿਸ ਵਿੱਚ ਸ਼ਹਿਦ ਅਤੇ ਮੋਮ ਛਿੱਲਾਂ ਤੋਂ ਚਮੜੀ ਫਸਲ ਲਈ ਖਾਦ ਸ਼ਿਲਪਕਾਰੀ ਲਈ ਖੱਪ ਅਤੇ ਰੇਸ਼ਮ ਦੀ ਕੀੜੀਆਂ ਤੋਂ ਰੇਸ਼ਮ ਸ਼ਾਮਲ ਹਨ ਇਸ ਤੋਂ ਇਲਾਵਾ ਅਲਪਾਕਾ ਉਨ ਅੰਗੋਰਾ ਉਨ ਅਤੇ ਕਸ਼ਮੀਰੀ ਵਰਗੇ ਰੇਸ਼ੇ ਪ੍ਰਜਨਨ ਜਾਂ ਪ੍ਰਦਰਸ਼ਨ ਲਈ ਜੀਵਤ ਜਾਨਵਰਾਂ ਦੇ ਨਾਲ ਵੇਚੇ ਜਾ ਸਕਦੇ ਹਨ ਹੱਡੀਆਂ ਖੁਰਾ ਅਤੇ ਸਿੰਘਾਂ ਵਰਗੇ ਉਪ ਪਾਦਾਂ ਨੂੰ ਸ਼ਿਲਪਕਾਰੀ ਜਾਂ ਪਾਲਤੂ ਜਾਨਵਰਾਂ ਦੇ ਉਤਪਾਦਾਂ ਲਈ ਵੇਚਿਆਂ ਜਾ ਸਕਦਾ ਹੈ ਜਦੋਂ ਕਿ ਆਂਡੇ ਦੇ ਛਿਲਕਿਆਂ ਨੂੰ ਖਾਦ ਵਜੋਂ ਵੀ ਵਰਤਿਆ ਜਾਂਦਾ ਹੈ ਪਨੀਰ ਆਈਸਕ੍ਰੀਮ ਅਤੇ ਦਹੀਂ ਵਰਗੇ ਡੇਰੀ ਉਪ ਉਪਦ ਉਪ ਉਪਾਧ ਪਾਲਤੂ ਜਾਨਵਰਾਂ ਦੇ ਉਤਪਾਦਾਂ ਦੇ ਨਾਲ ਪਸ਼ੂ ਥੈਰੇਪੀ ਸੇਵਾਵਾਂ ਖੇਤੀਬਾੜੀ ਸੈਰ ਸਪਾਟਾ ਅਤੇ ਖਾਦ ਖਾਦ ਸਾਰੇ ਮੌਜੂਦਾ ਲਾਭਦਾਇਕ ਉੱਦਮ ਹਨ